ਖਪਤਕਾਰ ਸਥਾਨਿਕ ਤੌਰ 'ਤੇ ਪ੍ਰਾਪਤ ਕੀਤੇ ਜੈਵਿਕ ਅਤੇ ਮੁਕਤ ਰੇਜ਼ ਵਾਲੇ ਜਾਨਵਰਾਂ ਦੇ ਉਤਪਾਦਾਂ ਦੀ ਚੋਣ ਕਰਕੇ ਟਿਕਾਊ ਅਤੇ ਨੈਤਿਕ ਪਸ਼ੂ ਪਾਲਣ ਅਭਿਆਸਾਂ ਦਾ ਸਮਰਥਨ ਕਰ ਸਕਦੇ ਹਨ ਜੋ ਜਾਨਵਰਾਂ ਦੇ ਮਨੁੱਖੀ ਇਲਾਜ ਨੂੰ ਉਤਸਾਹਿਤ ਕਰਦੇ ਹਨ ਅਤੇ ਵਾਤਾਵਰਣ ਪ੍ਰਭਾਵ ਨੂੰ ਘਟਾਉਂਦੇ ਹਨ ਕਿਸਾਨਾਂ ਦੇ ਬਜ਼ਾਰਾਂ ਜਾਂ ਕਮਿਊਨਿਟੀ ਸਮਰਥਿਤ ਖੇਤੀਬਾੜੀ ਪ੍ਰੋਗਰਾਮਾਂ ਦੇ ਸਿੱਧੀ ਖਰੀਦਦਾਰੀ ਰਾਹੀਂ ਛੋਟੇ ਪੱਧਰ ਦੇ ਕਿਸਾਨਾਂ ਦਾ ਸਮਰਥਨ ਨੈਤਿਕ ਖੇਤੀ ਤਰੀਕਿਆਂ ਨੂੰ ਕਾਇਮ ਰੱਖਣ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਸਰਕਾਰੀ ਯੋਜਨਾਵਾਂ ਜਿਵੇਂ ਸਬਸਿਡੀਆਂ ਗਰਾਂਟਾ ਅਤੇ ਸਿਖਲਾਈ ਪ੍ਰੋਗਰਾਮ ਕਿਸਾਨਾਂ ਨੂੰ ਟਿਕਾਊ ਅਭਿਆਸਾਂ ਨੂੰ ਅਪਣਾਉਣ ਵਿੱਚ ਸਹਾਇਤਾ ਕਰਦੇ ਹਨ